ਪੰਜਾਬ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਵਿਸ਼ੇਸ਼ ਲੋੜ ਲੋੜ ਵਾਲੇ ਵਿਦਿਆਰਥੀ ਜਾਂ ਜਿਹੜੇ ਅਸਮੱਰਥਾ ਵਾਲੇ ਵਿਦਿਆਰਥੀ ਦੇ ਬਾਹਲੀ ਅਨੁਕੂਲਤ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਨਾ ਤਾਂ ਉਹ ਉੱਥੇ ਫੈਸਲਿਟੀਜ਼ ਦਿੱਤੀਆਂ ਜਾਂਦੀਆਂ ਨੇ ਜਿਹੜੇ ਹੈਗੇ ਨੇ ਬੱਚੇ ਅਤੇ ਨਾ ਹੀ ਉਹਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਆਪਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਵਾਸਤੇ ਜਿਹੜੀ ਰਿਹਾਇਸ਼ ਹੈਗੀ ਹੈ ਰਿਹਾਇਸ਼ ਜਾਂ ਜਿਹੜੇ ਉਥੇ ਸਰੋਤ ਸ ਕਾ ਸਕੂਲ ਕਾਲਜ 'ਚ ਚਾਹੀਦੇ ਨੇ ਉਹਨਾਂ ਬਨੀ ਜ਼ਿਆਦਾ ਧਿਆਨ ਦਿੱਤਾ ਜਾਵੇ